ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਅੱਜ ਤੁਹਾਡੇ ਨਾਲ ਭੰਗੜੇ ਦੀ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਪਹਿਲੇ ਵਿਚਾਰ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕਿ ਪਹਿਰਾਵਾ ਪਹਿਨਿਆ ਜਾਂਦਾ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕੁੜਤੇ ਪਜਾਮੇ ਕੁੜਤਿਆਂ ਦੀ ਜਿਸ ਵਿੱਚ ਵਰਾਇਟੀਆਂ ਭਾਵ ਕਿ ਅਨਾਰਕਲੀ ਕੁੜਤਾ ਪਜਾਮਾ ਲਾਚਾ ਪੱਗਾਂ ਆਦਿ ਪਹਿਨੀਆਂ ਜਾਂਦੀਆਂ ਹਨ ਜਿਸ ਦੇ ਨਾਲ ਸਾਡੇ ਟਰਡੀਸ਼ਨਲ ਕੁਝ ਗਹਿਣੇ ਭਾਵ ਕੈਂਠਾ ਤਵੀਤੜੀਆਂ ਆਦਿ ਪਹਿਨੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਨਾਲ ਉਹ ਕੁੜਤੇ ਰੰਗ ਬਰੰਗੇ ਭਾਵ ਕਿ ਨੀਲੇ ਚਿੱਟੇ ਹਰੇ ਵੀ ਹੋ ਸਕਦੇ ਹਨ ਅਤੇ ਪੱਗਾਂ ਦੇ ਰੰਗ ਵੀ ਅਲੱਗ ਅਲੱਗ ਹੋ ਸਕਦੇ ਹਨ ਜਿਸ ਦੇ ਵਿੱਚ ਪੱਗਾਂ ਤੁਰਲੇ ਵਾਲੀਆਂ ਬੰਨੀਆਂ ਜਾਂਦੀਆਂ ਹਨ ਅਤੇ ਲਾਚੇ ਲਿਸ਼ਕਣੇ ਬੰਨ੍ਹੇ ਜਾਂਦੇ ਹਨ ਇਸ ਵਿੱਚ ਭੰਗੜੇ ਦੇ ਅਦਾਕਾਰ ਭੰਗੜੇ ਨੂੰ ਢੋਲ 'ਤੇ ਨੱਚ ਕੇ ਵਿਖਾਉਂਦੇ ਹਨ ਜਿਸ ਦੇ ਵਿੱਚ ਉਹੀ ਇੱਕ ਢੋਲ ਦੇ ਸੰਗੀਤ ਨੂੰ ਆਪਣੇ ਅਦਾਕਾਰੀ ਦੇ ਨਾਲ ਪੇਸ਼ ਕਰਦੇ ਹਨ ਅਤੇ ਡਾਂਸ ਕਰਨ ਵਾਲਿਆਂ ਨੂੰ ਆਕਰਸ਼ਿਕ ਬਣਾਉਣ ਲਈ ਭੰਗੜੇ ਨੂੰ ਆਕਰਸ਼ਿਕ ਬਣਾਉਣ ਲਈ ਉਹ ਆਪਣੇ ਕੁਝ ਸਟੈਪਾਂ ਨੂੰ ਇਵੇਂ ਕਰਦੇ ਹਨ ਕਿ ਦੇਖਣ ਵਾਲੇ ਹੀ ਝੂੰਮ ਨੱਚਦੇ ਹਾਂ ਢੋਲ 'ਤੇ ਨਗਾੜਿਆਂ 'ਤੇ ਭੰਗੜੇ ਨੂੰ ਕਰਨਾ ਕਾਫੀ ਆਸਾਨ ਹੋ ਜਾਂਦਾ ਹੈ ਜਿਸ ਦੇ ਵਿੱਚ ਉਹ ਆਪਣੇ ਪੈਰਾਂ ਦੇ ਵਿੱਚ ਘੁੰਗਰੂ ਵੀ ਪਹਿਨਦੇ ਹਨ ਤਾਂ ਕਿ ਪੈਰ ਦੇ ਚੁੱਕਣ ਦੇ ਨਾਲ ਨਾਲ ਘੁੰਗਰੂਆਂ ਦੀ ਵੀ ਆਵਾਜ਼ ਜਿਹੜੀ ਉਹ ਗੂੰਜੇ ਅਤੇ ਢੋਲ ਦੇ ਵੱਜਣ ਦੇ ਨਾਲ ਉਹਨਾਂ ਦੇ ਹੱਥ ਜਿਹੜੇ ਹਵਾ ਵਿੱਚ ਝੂਲਦੇ ਹਨ ਅਤੇ ਉਹਨਾਂ ਦੇ ਚਿਹਰੇ 'ਤੇ ਮੁਸਕਾਨ ਅਤੇ ਉਹਨਾਂ ਦੇ ਹਾਸਿਆਂ ਅਤੇ ਮੁਸਕਾਨ ਜਿਹੜੀ ਉਹ ਦਿਖਦੀ ਹੈ